ਹੈਲੋ ਸਤਿ ਸ਼੍ਰੀ ਅਕਾਲ ਆਂਟੀ ਜੀ ਆਂਟੀ ਜੀ ਆਪਾਂ ਕੱਲ੍ਹ ਸ਼ਾਮ ਨੂੰ ਗੁਰਦੁਆਰਾ ਸਾਹਿਬ ਮਿਲੇ ਸੀ ਨਾ ਜੀ ਤਰਨ ਤਾਰਨ ਮੈਂ ਤੁਹਾਡੇ ਤੋਂ ਨੰਬਰ ਲਿੱਤਾ ਸੀ ਹਾਂਜੀ ਅਸੀਂ ਤੁਹਾਡੀ ਗਲੀ 'ਚ ਨਵੇਂ ਗੁਆਂਢੀ ਆਏ ਹਾਂ ਜੀ ਜਿਹੜੇ ਅਸੀਂ ਤਾਂ ਕੱਲ੍ਹ ਹੀ ਪਰਸੋਂ ਆਏ ਹਾਂ ਜੀ ਹਜੇ ਹਾਂਜੀ ਮੇਰੇ ਹਸਬੈਂਡ ਦੇ ਕੱਲ੍ਹ ਹਾਂਜੀ ਹਾਂਜੀ ਮੇਰੇ ਹਸਬੈਂਡ ਦੀ ਬਦਲੀ ਹੋਈ ਹੈ ਜੀ ਹਾਂਜੀ ਹਾਂਜੀ ਅਸੀਂ ਨਾ ਜੀ ਤੁਹਾਡੇ ਤੋਂ ਸਬਜ਼ੀਆਂ ਅਤੇ ਫਰੂਟਾਂ ਬਾਰੇ ਪੁੱਛਣਾ ਸੀਗਾ ਹਾਂਜੀ ਵੀ ਘਰ ਤੁਹਾਨੂੰ ਪਤਾ ਚਾਹੀਦੀ ਹੁੰਦੀ ਹੈ ਸਬਜ਼ੀ ਵੀ ਫਰੂਟ ਵਗੈਰਾ ਲੈਂਦੇ ਹਾਂ ਹਾਂਜੀ ਵੀ ਕਿੱਥੋਂ ਵਧੀਆ ਅਤੇ ਤਾਜ਼ੀ ਸਬਜ਼ੀ ਮਿਲਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਜੀ ਹਾਂਜੀ ਹਾਂਜੀ ਅਤੇ ਫਿਰ ਤੁਸੀਂ ਚੱਲੋਂਗੇ ਜੀ ਕੱਲ੍ਹ ਨੂੰ ਸੁਬਹਾ ਮੇਰੇ ਨਾਲ ਮੇਰੇ ਤੋਂ ਕਿ ਅਸੀਂ ਤਾਂ ਨਵੇਂ ਆਏ ਹੋਏ ਹਾਂ ਸਾਨੂੰ ਤਾਂ ਕੋਈ ਪਤਾ ਨੀਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਆਂਟੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਆਂਟੀ ਜੀ ਓਕੇ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ